ਮੈਂ ਪੰਜਾਬ ਦੇ ਇੱਕ ਛੋਟੇ ਦੇ ਜਿਹੇ ਪਿੰਡ ਵਿੱਚ ਰਹਿੰਦਾ ਹਾਂ ਅਤੇ ਮੈਂ ਇੱਕ ਕਿਸਾਨ ਹਾਂ ਅੱਜ ਦੇ ਦੌਰ ਵਿੱਚ ਖੇਤੀ ਕਰਨ ਵਿੱਚ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ ਅਤੇ ਬਹੁਤ ਨੁਕਸਾਨ ਵੀ ਚੱਕਣੇ ਪੈਂਦੇ ਹਨ ਨੁਕਸਾਨ ਕਈ ਕਾਰਨ ਕਰਕੇ ਚੱਕਣੇ ਪੈਂਦੇ ਹਨ ਜਿਵੇਂ ਕਿ ਕਾਫੀ ਮੀਂਹ ਪੈ ਜਾਣਾ ਹੜ ਆ ਜਾਣੇ ਕਦੇ ਕਦੇ ਪਾਣੀ ਦੀ ਸਮੱਸਿਆ ਹੋ ਜਾਣਾ ਕਦੇ ਅੱਗ ਲੱਗ ਜਾਣਾ ਮਜ਼ਦੂਰ ਦਾ ਨਾ ਲੱਭਣਾ ਫਸਲਾਂ ਨੂੰ ਕੀੜਾ ਲੱਗ ਜਾਣਾ ਅਤੇ ਹੋਰ ਵੀ ਕਈ ਕਾਰਨ ਜਿਸ ਕਰਕੇ ਨੁਕਸਾਨ ਹੁੰਦਾ ਹੁੰਦਾ ਹੈ ਅਸੀਂ ਕਿਸਾਨ ਆਪਣੀ ਸਾਰੀ ਜਮ੍ਹਾਂ ਪੂੰਜੀ ਖੇਤੀ 'ਤੇ ਲਾ ਦਿੰਦੇ ਹਾਂ ਪਰ ਅਗਰ ਕਿਸੀ ਕਾਰਨ ਕਰਕੇ ਫਸਲ ਖਰਾਬ ਹੁੰਦੀ ਹੈ ਤਾਂ ਸਾਡੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਕਿਉਂਕਿ ਫਸਲ ਸਾਡੇ ਬੱਚਿਆਂ ਵਾਂਗੂੰ ਹੀ ਹੁੰਦੀ ਹੈ ਇਸ ਨੁਕਸਾਨ ਤੋਂ ਬਚਣ ਲਈ ਮੈਨੂੰ ਫਸਲ ਬੀਮਾ ਪੋਲਸੀਆਂ ਬਾਰੇ ਦੱਸੋ ਜਿਸ ਕਰਕੇ ਕਿ ਮੈਂ ਇਸ ਵਰਕਸ਼ਾਪ ਵਿੱਚ ਹਿੱਸਾ ਲਿੱਤਾ ਹੈ ਤਾਂ ਕਿ ਸਾਡਾ ਨੁਕਸਾਨ ਘੱਟ ਤੋਂ ਘੱਟ ਹੋਵੇ ਅਤੇ ਪੰਜਾਬ ਦਾ ਕਿਸਾਨ ਖੁਸ਼ ਰਹੇ ਉਸੀ ਵਿੱਚ ਮੈਨੂੰ ਇਹ ਵੀ ਦੱਸੋ ਕਿ ਇਸ ਵਿੱਚ ਕਿਹੜੇ ਕਿਹੜੇ ਨੁਕਸਾਨ ਝੇਲੇ ਜਾਂਦੇ ਨੇ ਜਿਵੇਂ ਕਿ ਫਸਲ ਨੂੰ ਅੱਗ ਲੱਗ ਜਾਣਾ ਜਾਂ ਕੁਝ ਹੋਰ ਵੀ ਅਤੇ ਇਹਦੇ ਵਿੱਚ ਕਿੰਨੇ ਪੈਸੇ ਸਾਨੂੰ ਦੇਣੇ ਪੈਂਦੇ ਨੇ ਅਤੇ ਸਾਨੂੰ ਕਿੰਨਾ ਇਹਦਾ ਬੀਮਾ ਮਿਲੇਗਾ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕੀਏ ਧੰਨਵਾਦ